ਮੈਂ ਪ੍ਰੇਮ ਸਿੰਘ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਪਠਾਨਕੋਟ ਦੇ ਵਿੱਚ ਸਬਜ਼ੀਆਂ ਅਤੇ ਅਨਾਜ ਜਿੱਦਾਂ ਕਣਕ ਜਵਾਰ ਅਤੇ ਝੋਨਾ ਗੰਨਾ ਦਾਲਾਂ ਆਦਿ ਬੀ ਬੀਜੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਪੰਜਾਬ ਦੇ ਵਿੱਚ ਮੌਸਮ ਅਨੁਸਰ ਅਨਾਜ ਬੀਜਿਆ ਜਾਂਦਾ ਹੈ ਤਾਂ ਜੋ ਗਰਮੀ ਵਿੱਚ ਸਾਨੂੰ ਆਲੂ ਅਤੇ ਔਰ ਮੂਲੀ ਵਗੈਰਾ ਜਾਂ ਟਮਾਟਰ ਇਹ ਚੀਜ਼ਾਂ ਗਰਮੀਆਂ ਵਿੱਚ ਅਤੇ ਲੌਕੀ ਘੀਆ ਅਤੇ ਕੱਦੂ ਇਹ ਸਾਡੀ ਆਮ ਗਰਮੀਆਂ ਵਾਲੀਆਂ ਫਸਲਾਂ ਹਨ ਸਰਦੀਆਂ ਵਿੱਚ ਵੀ ਬਣਾਈ ਬੀਜੀਆਂ ਜਾਂਦੀਆਂ ਹਨ ਪਰ ਕਿਉਂ ਹੁਣ ਸਾਨੂੰ ਮੰਡੀ ਵਿੱਚ ਜਾਣ ਦੀ ਦਿੱਕਤ ਕੋਈ ਨਹੀਂ ਆਉਂਦੀ ਕਿਉਂਕਿ ਮੰਡੀ ਵਿੱਚ ਅਸੀਂ ਸਬਜ਼ੀ ਅਨਾਜ ਤਾਂ ਗੇੇਂਹੂੰ ਜਾਂ ਹੋਰ ਕੁਝ ਜਿਹੜੀਆਂ ਜਵਾਰ ਔਰ ਝੋਨਾ ਹੈ ਇਹ ਅਸੀਂ ਮੰਡੀ ਵਿੱਚ ਮੌਸਮ ਅਨੁਸਾਰ ਲੈਂਦੇ ਹਾਂ ਅਤੇ ਜਿਹੜੀਆਂ ਸਬਜ਼ੀਆਂ ਹੈ ਅੱਜ ਕੱਲ੍ਹ ਸਦਾ ਬਹਾਰ ਸਬਜ਼ੀਆਂ ਹਨ ਜੋ ਕਿ ਸਾਨੂੰ ਅਸੀਂ ਰੋਜ਼ ਹੀ ਤੋੜ ਕੇ ਅਤੇ ਹਰ ਮੌਸਮ ਦੇ ਵਿੱਚ ਲਿਜਾ ਸਕਦੇ ਹਾਂ ਜਿੱਦਾ ਆਲੂ ਪਿਆਜ਼ ਟਮਾਟਰ ਇਹ ਤਾਂ ਮੇਨ ਸਬਜ਼ੀਆਂ ਹਨ